ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਆਪਣੇ ਪੱਧਰ 'ਤੇ ਬਹੁਤ ਹੀ ਜ਼ ਵਧੀਆ ਕੰਮ ਕਰ ਰਹੀ ਹੈ ਪਹਿਲਾਂ ਨਾਲ ਦੇ ਮੁਕਾਬਲੇ ਵਿੱਚ ਹੁਣ ਬਹੁਤ ਜ਼ਿਆਦਾ ਕੰਮ ਹੋ ਰਿਹਾ ਜਿਵੇਂ ਕਿ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਨਵੇਂ ਸਕੂਲ ਬਣ ਰਹੇ ਨੇ ਸਕੂਲਾਂ ਵਿੱਚ ਪੁਰਾਣੇ ਸਕੂਲਾਂ ਦੇ ਵਿੱਚ ਕਮਰਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਬਦ ਵੱਧ ਰਹੀ ਹੈ ਅਤੇ ਸਕੂਲਾਂ ਨੂੰ ਫੰਡਿੰਗ ਵੀ ਪੰਜਾਬ ਸਰਕਾਰ ਵੱਲੋਂ ਬਦੀ ਵਧਾਈ ਜਾ ਰਹੀ ਹੈ ਟੀਚਰਾਂ ਦੀ ਭਰਤੀ ਵੀ ਹੌਲੀ ਹੌਲੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਪਹਿਲਾਂ ਪਿੰਡਾਂ ਦੇ ਵਿੱਚ ਟੀਚਰ ਦੀ ਘਾਟ ਹੁੰਦੀ ਸੀ ਕਿ ਟੀਚਰ ਨਹੀਂ ਹੁੰਦੇ ਸੀ ਹੁਣ ਓਹ ਵੀ ਪੰਜਾਬ ਦੀ ਸਿੱਖਿਆ ਪੰਜਾਬ ਸਰਕਾਰ ਨੇ ਓਹਨੂੰ ਵੀ ਸਹੀ ਕੀਤਾ ਹੈ ਅਤੇ ਜਿੱਥੇ ਟੀਚਰ ਨਹੀਂ ਸੀ ਉੱਥੇ ਟੀਚਰ ਪਹੁੰਚਾਏ ਨੇ ਜਿੱਥੇ ਬੱਚਿਆਂ ਦੀ ਗਿਣਤੀ ਵਧੀ ਹੈ ਉੱਥੇ ਕਲਾਸਾਂ ਦੀ ਕਮਰੇ ਵਧਾਏ ਨੇ ਕਲਾਸਰੂਮ ਵੀ ਵਧਾਏ ਨੇ ਔਰ ਜਿੱਥੇ ਸਕੂਲ ਨਹੀਂ ਹੈਗੇ ਉੱਥੇ ਸਕੂਲਾਂ ਦੀ ਵੀ ਬਣਾਏ ਨੇ ਜਿੱਥੇ ਸਕੂਲਾਂ ਦੀ ਹਾਲਤ ਮਾੜੀ ਸੀ ਓਹਦੀ ਹਾਲਤ ਦੇ ਵਿੱਚ ਸੁਧਾਰ ਹੋਇਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫ਼ਰਕ ਪਿਆ ਸੋ ਪੰਜਾਬ ਸਰਕਾਰ ਵਧੀਆ ਕੰਮ ਰਹੀ ਹੈ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਪ੍ਰਤੀ